ਸਰਕਾਰ ਨੇ ਖੁਰਾਕ ਦੀ ਵੰਡ ਲਈ ਕਈ ਨੀਤੀਆਂ ਅਪਣਾਈਆਂ ਹੋਈਆਂ ਹਨ ਜਿਸ ਤਰ੍ਹਾਂ ਕਿ ਗਰੀਬਾਂ ਲਈ ਨੀਲੇ ਕਾਰਡ ਬਣਾਏ ਹੋਏ ਹਨ ਨੀਲੇ ਕਾਰਡ ਦੇ ਨਾਲ ਲੋਕਾਂ ਨੂੰ ਸਸਤਾ ਰਾਸ਼ਨ ਦਿੱਤਾ ਜਾਂਦਾ ਹੈ ਕਣਕ ਦ ਦਾਲਾਂ ਚਾਵਲ ਵੀ ਬ ਦਿੱਤੀਆਂ ਜਾਂਦੀਆਂ ਹਨ ਔਰ ਸਕੂਲਾਂ ਵਿੱਚ ਮਿਡਡੇ ਮੀਲ ਦੇ ਦਿੱਤਾ ਜਾਂਦਾ ਹੈ ਤਾਂ ਕਿ ਬੱਚੇ ਉੱਥੇ ਰੋਟੀ ਖਾ ਸਕਣ ਗਰੀਬ ਬੱਚੇ ਘਰੋਂ ਰੋਟੀ ਨਾ ਲਿਆਉਣ ਅਤੇ ਉੱਥੇ ਹੀ ਸ ਬਹਿ ਕੇ ਖਾ ਖਾਣ ਉਸ ਖੁਰਾਕ ਦੀ ਵੰਡ ਲਈ ਸਰਕਾਰ ਨੇ ਹੋਰ ਵੀ ਡੀਪੂ ਲਗ ਖੋਲ੍ਹੇ ਹੋਏ ਹਨ ਜਿਹਨਾਂ ਤੋਂ ਨੀਲੇ ਕਾਰਡ ਨਹੀਂ ਬਣੇ ਹੋਏ ਉਹ ਡੀਪੂਆਂ ਤੋਂ ਵੀ ਸਸਤਾ ਰਾਸ਼ਨ ਲੈਂਦੇ ਹਨ ਸਾਡੀ ਸਰਕਾਰ ਨੇ ਖੁਰਾਕ ਦੀ ਵੰਡ ਲਈ ਬਹੁਤ ਕੁਛ ਕੀਤਾ ਹੋਇਆ ਹੈ ਜਿਸ ਵਿੱਚ ਗਰੀਬਾਂ ਨੂੰ ਬਹੁਤ ਮਦਦ ਕੀਤੀ ਗਈ ਹੈ ਖੁਰਾਕ ਦੀ ਵੰਡ ਲਈ ਅਲੱਗ ਅਲੱਗ ਡੀਪੂਆਂ 'ਤੇ ਜਾ ਕੇ ਕੁਛ ਸਾਰਾ ਰਾਸ਼ਨ ਮਿਲਦਾ ਹੈ ਅਤੇ ਸਰਕਾਰ ਨੇ ਗਰੀਬਾਂ ਨੂੰ ਖੁ ਇਹ ਹੀ ਦਿੱ ਖੁਰਾਕ ਦੀ ਵੰਡ ਲਈ ਸਰਕਾਰ ਇਹ ਕਹਿੰਦੀ ਹੈ ਕਿ ਕੋਈ ਵੀ ਮ ਗਰੀਬ ਬੰਦਾ ਰੋ ਰੋਟੀ ਤੋਂ ਬਿਨਾਂ ਨਾ ਰਹੇ ਇਸ ਲਈ ਸਸਤੇ ਤੋਂ ਸਸਤਾ ਰਾਸ਼ਨ ਵੀ ਮੁਹੱਈਆ ਕਰਵਾ ਰਹੀ ਹੈ ਸਰਕਾਰ ਇਹ ਬੜੇ ਅੱਛੇ ਕ ਕਦਮ ਚੁੱਕ ਰਹੀ ਹੈ ਤਾਂ ਕਿ ਗਰੀਬਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲੇ ਦ ਹਰ ਬੰਦਾ ਰਾਤ ਨੂੰ ਰੋਟੀ ਖਾ ਕੇ ਸੋਵੇ ਸਰਕਾਰ ਸਕੂਲਾਂ ਵਿੱਚ ਬੱਚਿਆਂ ਨੂੰ ਫਰੀ ਮਿਡਡੇ ਮੀਲ ਤੋਂ ਭੋਜਨ ਕਰਵਾਉਂਦੀ ਹੈ ਤਾਂ ਕਿ ਬੱਚੇ ਅੱਛਾ ਖਾਣਾ ਖਾ ਸਕਣ ਧੰਨਵਾਦ